ਹੈਲੋ ਹਾਂਜੀ ਨਮਸਤੇ ਜੀ

ਨਹੀਂ ਬਹੁਤ ਵਧੀਆ ਇਸ ਵਾਰੀ ਤਾਂ ਫਸਲ ਵੀ ਬਹੁਤ ਅੱਛੀ ਹੋਈ ਹੈ ਅਤੇ ਕਿਸਾਨਾਂ ਨੂੰ ਵੀ ਕਾਫੀ ਮੁਆਵਜ਼ਾ ਮਊਵਜ਼ਾ ਵੀ ਮਿਲ ਜਾਂਦਾ ਹੈ ਕਾਫੀ ਸਰਕਾਰ ਵੀ ਕਾਫੀ ਉਪਰਾਲੇ ਕਰ ਰਹੀ ਹੈ ਇਹਨਾਂ ਦੀ ਮਦਦ ਕਾਫੀ ਕਰ ਰਹੀ ਹੈ ਅਤੇ ਨਵੀਆਂ ਨਵੀਆਂ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦੀ ਕਿਸਾਨਾਂ ਨੂੰ ਵੀ ਕਿਸਾਨ ਵੀ ਬਹੁਤ ਖੁਸ਼ ਹੈ ਔਰ ਵੈਸੇ ਵੀ ਪੰਜਾਬ ਦੀ ਧਰਤੀ ਤੁਹਾਨੂੰ ਪਤਾ ਵੈਸੇ ਉਪਜਾਊ ਹੈ ਅਤੇ ਝੋਨਾ ਕਣਕ ਤਾਂ ਬਹੁਤ ਵਧੀਆ ਹੁੰਦਾ ਹਰ ਸਾਲ ਕਿਸਾਨ ਬਹੁਤ ਖੁਸ਼ ਹੁੰਦੇ ਹੈ ਨਵੀਆਂ ਨਵੀਆਂ ਹਾਂਜੀ ਹਾਂਜੀ ਇਹ ਤਾਂ ਹੈ ਹੀ ਇਹ ਤਾਂ ਹੈ ਹੀ ਹਾਂਜੀ ਹਾਂਜੀ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਕਿਸਾਨਾਂ ਦੀ ਸੁ ਹਾਲਤ ਸੁਧਾਰਨ ਵਾਸਤੇ ਬਹੁਤ ਵਧੀਆ ਵਧੀਆ ਉਹਨਾਂ ਨੇ ਫਸਲੀਟੀਆਂ ਕੱਢੀਆਂ ਮਸ਼ੀਨਾਂ ਲਗਾ ਤੀਆਂ ਦਵਾਈਆਂ ਕੱਢਤੀਆਂ ਔਰ ਲ ਮੁਆ ਮੁਆਵਜ਼ੇ ਵੀ ਟਾਈਮ ਟੂ ਟਾਈਮ ਹਰ ਚੀਜ਼ ਦੇ ਮੁਆਵਜ਼ੇ ਵੀ ਮਿਲਦੇ ਰਹਿੰਦੇ ਕਿਸਾਨ ਨੂੰ ਕਿਸਾਨ ਵੀ ਕਾਫੀ ਖੁਸ਼ ਹੈ ਧਰਤੀ ਵੀ ਉਪਜਾਊ ਹੈ ਹਰ ਚੀਜ਼ ਬਹੁਤ ਵਧੀਆ ਫਸਲ ਬਹੁਤ ਵਧੀਆ ਹੁੰਦੀ ਹੈ ਇੱਥੇ ਨਹੀਂ ਹੁਣ ਹੈ ਤਾਂ ਹੈ ਕਾਫੀ ਅਪ ਸਰਕਾਰ ਕਾਫੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਕਿਸਾਨਾਂ ਨੂੰ ਖੁਸ਼ ਕਰਨ ਦੀ ਫਸਲਾਂ ਵਧੀਆ ਹੁੰਦੀਆਂ ਬਾਰਿਸ਼ ਟਾਈਮ ਟੂ ਟਾਈਮ ਪੈਂਦੀ ਰਹਿੰਦੀ ਹੈ ਬਾਰਿਸ਼ ਪਾਣੀ ਪੂਣੀ ਫਿਰ ਲੱਗਦਾ ਰਹਿੰਦਾ ਬਾਕੀ ਕੁਦਰਤੀ ਮੌਸਮ ਮੈਮ ਕੁਦਰਤੀ ਮੌਸਮ ਵੀ ਵਧੀਆ ਜਿਹਦੇ ਕਰਕੇ ਫਸਲਾਂ ਨੂੰ ਕਾਫੀ ਸਹਾਇਤਾ ਮਿਲਦੀ ਹੈ ਵਧੀਆ ਹੈ ਸੋ ਬਹੁਤ ਵਧੀਆ ਮੌਸਮ ਵੀ ਵਧੀਆ ਇੱਥੋਂ ਦਾ ਪੰਜਾਬ ਦਾ ਨਮਸਕਾਰ ਜੀ